ਪਿਛਲੇ ਮ ਸਮਿਆਂ ਦੇ ਮੁਕਾਬਲੇ ਸਾਡੇ ਖੇਤਰ ਦੇ ਵਿੱਚ ਕਾਫ਼ੀ ਵਿਕਾਸ ਹੋਇਆ ਹੈ ਸੜਕਾਂ ਚੌੜੀਆਂ ਕਰ ਦਿੱਤੀਆਂ ਗਈਆਂ ਹਨ ਨਾਲੀਆਂ ਬਣਾਈਆਂ ਗਈਆਂ ਹਨ ਪੁੱਲ ਵੱਡੇ ਵੱਡੇ ਬਣਾ ਦਿੱਤੇ ਗਏ ਹਨ ਤਾਂ ਜੋ ਟਰੈਫਿਕ ਜਾਮ ਨੂੰ ਘਟਾਇਆ ਜਾ ਸਕੇ ਲੋਕਾਂ ਦਾ ਜਾਣਾ ਆਉਣਾ ਆਸਾਨ ਹੋ ਸਕੇ ਲੋਕ ਇਹਨਾਂ ਵਿਕਾਸਾਂ ਤੋਂ ਖੁਸ਼ ਵੀ ਹਨ ਟਰੇਨਾਂ ਚਲਾਈਆਂ ਗਈਆਂ ਹਨ ਸ਼ਤਾਬਦੀ ਐਕਸਪਰੈਸ ਚਲਾਈ ਗਈ ਹੈ ਹੁਣ ਬੰਦੇ ਭਾਰਤ ਟਰੇਨ ਜਿਹੜੀ ਹੈ ਉਹ ਵੀ ਸਾਡੇ ਖੇਤਰ ਚੋਂ ਚਲਦੀ ਹੈ ਇਸ ਨਾਲ ਲੋਕਾਂ ਨੂੰ ਕਾਫ਼ੀ ਫ਼ਾਇਦਾ ਵੀ ਹੈ ਉਹਨਾਂ ਦਾ ਸਮਾਂ ਬਚਦਾ ਹੈ ਦੂਰ ਦਰਾਡੇ ਜਾਣ ਦੇ ਵਿੱਚ ਇਸ ਪ੍ਰਕਾਰ ਨਾਲ ਸਾਡੇ ਰਾਜ ਦੀ ਇਤਿਹਾਸਿਕ ਘਟਨਾ ਜਿਹੜੀ ਹੈ ਉਹ ਹੈ ਜਲ੍ਹਿਆਂਵਾਲਾ ਬਾਗ ਜਲ੍ਹਿਆਂਵਾਲੇ ਬਾਗ ਦੀ ਘਟਨਾ ਆਜ਼ਾਦੀ ਦੇ ਸਮੇਂ ਜਿਹੜੀ ਹੋਈ ਸੀ ਉਹ ਸਾਡੇ ਖੇਤਰ ਦੇ ਨਾਲ ਜੁੜੀ ਹੋਈ ਹੈ ਅੰਮ੍ਰਿਤਸਰ ਦੇ ਨਾਲ ਜਿਹੜੀ ਇਸ ਘਟਨਾ ਦਾ ਸਾਡੇ ਸਿੱਖ ਭਾਈਚਾਰੇ ਦੇ ਉੱਤੇ ਪੰਜਾਬੀ ਭਾਈਚਾਰੇ ਦੇ ਉੱਪਰ ਬਹੁਤ ਹੀ ਪ੍ਰਭਾਵ ਪਿਆ ਹੋਇਆ ਹੈ ਲੋਕ ਇਸ ਘਟਨਾ ਤੋਂ ਇੰਨੇ ਕੁ ਪ੍ਰਭਾਵਿਤ ਹੋਏ ਹੋਏ ਸੀ ਕਿ ਉਹ ਇਸ ਨੂੰ ਯਾਦ ਕਰਦੇ ਹਨ ਸਮਾਰਕ ਬਣਾਈਆਂ ਗਈਆਂ ਯਾਦਗਾਰ ਸਮਾਰਕ ਬਣਾਈਆਂ ਗਈਆਂ ਹਨ ਲੋਕ ਉੱਥੇ ਜਾਂਦੇ ਹਨ ਆਪਣੇ ਇਤਿਹਾਸ ਨੂੰ ਯਾਦ ਕਰਦੇ ਹਨ ਧੰਨਵਾਦ